ਹੈਲੋ ਹੈਲੋ ਹਾਂਜੀ ਵਧੀਆ ਤੁਸੀਂ ਦੱਸੋ ਹਾਂਜੀ ਹਾਂਜੀ ਜ਼ਰੂਰ ਜੀ ਐਕਚੁਲੀ ਮੈਂ ਨਾ ਤੁਹਾਡੇ ਕੋਲੋਂ ਕੁਛ ਇਨਕੁਇਰੀ ਕਰਨੀ ਸੀਗੀ ਤੁਹਾਨੂੰ ਪਤਾ ਮੈਂ ਐਕਚੁਲੀ ਅਨਅਵੇਅਰ ਆ ਇਸ ਏਰੀਏ ਤੋਂ

ਹਾਂਜੀ ਓ ਫਸਟਲੀ ਤੁਹਾਨੂੰ ਪਤਾ ਹੀ ਹੈ ਜਿੱਦਾਂ ਮੈਂ ਫੂਡੀ ਪਰਸਨ ਆ ਅਤੇ ਮੈਨੂੰ ਔਰਗੈਨਿਕ ਵੈਰਟੇਬਲ ਫਰੂਟ ਜ਼ਿਆਦਾ ਪਸੰਦ ਆ ਅਤੇ ਮੈਨੂੰ ਤੁਸੀਂ ਦੱਸ ਦਿਓ ਵੀ ਇਹ ਮੈਂ ਥੋੜ੍ਹਾ ਜਿਹਾ ਫਿਮਲੀਰ ਹੋ ਜਾਵਾਂ ਏਰੀਅਸ ਤੋਂ ਹਾਂਜੀ ਓਕੇ

ਓਕੇ ਜੀ ਅਤੇ ਆਪਾਂ ਇੱਕ ਚੀਜ਼ ਹੋਰ ਪੁੱਛਣੀ ਸੀ ਇਹ ਜਿਹੜੀ ਮੇਰੀ ਲੋਕੇਸ਼ਨ ਆ ਮੇਰੀ ਮਤਲਬ ਜਿਹੜਾ ਹਾਊਸ ਮੈਂ ਅਪਾਰਟਮੈਂਟ ਲਿਆ ਹੈ ਉਹ ਬਾਗੀ ਹੋਸਪਿਟਲ ਦੇ ਨੀਅਰ ਆ ਇਹ ਬਾਗੀ ਬਾਗੀ ਹੋਸਪਿਟਲ ਦੇ ਨੀਅਰ ਹੀ ਪਏਗੀ ਨਾ ਇਹ ਲੋਕੇਸ਼ਨ ਹਾਂਜੀ ਹਾਂਜੀ ਓਕੇ ਜੀ ਅਤੇ ਮੈਂ ਥੋੜ੍ਹਾ ਜਿਹਾ ਪੁੱਛਣਾ ਸੀਗਾ ਮਤਲਬ ਜਿੱਦਾਂ ਸ਼ੋਪਿੰਗ ਲਈ ਗਰੋਸਰੀ ਲਈ ਆਪਾਂ ਨੂੰ ਵਿਸ਼ਾਲ ਮੈਗਾ ਮਾਰਕੀਟ ਦੀ ਇੱਥੇ ਨੀਅਰ ਅਬਾਊਟ ਕੋਈ ਲੋਕੇਸ਼ਨ ਮਿਲ ਜਾਏਗੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਦੱਸੋ ਹਾਂਜੀ ਜ਼ਰੂਰ ਜੀ ਇਕ ਮੇਨ ਚੀਜ਼ ਆ ਵੀ ਲਾਈਕ ਆ ਮੈਂ ਘਰ ਦਾ ਥੋੜ੍ਹਾ ਜਿਹਾ ਫਰਨੀਚਰ ਆ ਉਹ ਮੈਨੂੰ ਮਤਲਬ ਤੁਸੀਂ ਦੱਸ ਸਕਦੇ ਹੋ ਫਿਰੋਜ਼ਪੁਰ 'ਚ ਆਪਾਂ ਬੈਸਟ ਫਰਨੀਚਰ ਮਿਲ ਜਾਏਗਾ ਜਾਂ ਫਿਰ ਆਪਾਂ ਨੂੰ ਜੀਰੇ ਵਾਲੀ ਸਾਈਡ ਤੋਂ ਵੀਜਿਟ ਕਰਨਾ ਪਏਗਾ ਹਾਂਜੀ ਹਾਂਜੀ ਇੱਕ ਮੈਂ ਪੁੱਛਣਾ ਸੀ ਕਿ ਮੈਂ ਆਪਣੇ ਲੌਂਚ ਏਰੀਏ ਦੇ ਵਿੱਚ ਸੈਂਡਲੀਅਰ ਇੰਸਟਾਲ ਕਰਨਾ ਚਾਹੁੰਦੀ ਸੀ ਅਤੇ ਮੈਨੂੰ ਇਹ ਸੀਗਾ ਵੀ ਸ਼ੈ ਸੈਂਡਲੀਅਲ ਦੀ ਆਪਸ਼ਨ ਇੱਥੇ ਮਿਲ ਜਾਏਗੀ ਮੈਨੂੰ ਓਕੇ ਜੀ ਹਾਂਜੀ ਹਾਂਜੀ ਉੱਥੇ ਚਲੋ ਮੈਂ ਤੁਹਾਨੂੰ ਜ਼ਰੂਰ ਮਿਲਾਂਗੀ ਮੈਂ ਕਿਉਂਕਿ ਨੈਕਸਟ ਵੀਕ ਵਿਜਿਟ ਕਰ ਰਹੀ ਹਾਂ ਅਪਾਟਮੈਂਟ ਵਿੱਚ ਆਪਣੇ ਅਪਾਟਮੈਂਟ 'ਚ ਸ਼ਿਫਟ ਤੋਂ ਪਹਿਲਾਂ ਤਾਂ ਕਿ ਮੈਂ ਥੋੜ੍ਹਾ ਜਿਹਾ ਸਿਮਲੀਅਰ ਹੋ ਜਾਵਾਂ ਤੁਹਾਨੂੰ ਪਤਾ ਫਿਰ ਵਾਮ ਪਾਰਟੀ ਹਾਊਸ ਵਾਮਿੰਗ ਪਾਰਟੀ ਵੀ ਅਰੇਂਜ ਕੀਤੀ ਆ ਫਿਰ ਉਹਦੇ ਲਈ ਮੈਨੂੰ ਥੋੜ੍ਹਾ ਪਹਿਲਾਂ ਹੋਣਾ ਪਏਗਾ ਓਕੇ ਓਕੇ ਜੀ ਡਨ ਆ ਜੀ ਡਨ ਹੈ ਥੈਂਕ ਯੂ ਜੀ ਥੈਂਕ ਯੂ